ਧਨਵੰਤ ਸਿੰਘ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਮੇਰਾ ਪੋਤਰਾ ਮੇਰਾ ਪੋਤਰਾ ਵੀ ਤੇਰੇ ਪੋਤਰੇ ਜਿੱਡਾ ਅਤੇ ਹੁਣ ਇਹਨਾਂ ਦਾ ਸਕੂਲ ਸਕਾਲ ਦਾ ਵੀ ਕਿਹੜੇ ਹਾਂ ਕਿਹੜੇ ਹਾਂ ਪ੍ਰਾਈਵੇਟ 'ਚ ਸਰਕਾਰੀ 'ਚ ਬਠਿੰਡੇ ਕਿੱਥੇ ਕਿਵੇਂ ਹਾਂ ਕੋਈ ਇੱਥੇ ਤਾਂ ਫਿਰ ਇਹ ਛੋਟੇ ਬੱਚਿਆਂ ਲਈ ਤਾਂ ਹੈ ਨਹੀਂ ਨਾ ਆਹ ਉੱਧਰੋਂ ਉੱਥੇ ਉਹ ਵੀ ਮੇਰੇ ਖਿਆਲ 'ਚ ਛੋਟਿਆਂ ਲਈ ਨਹੀਂ ਉਹ ਤਾਂ ਸਪੋਰਟਸ ਹੈਗੀ ਵੱਡਿਆਂ ਵਾਸਤੇ ਆ ਹਾਂ ਅਤੇ ਬਠਿੰਡੇ ਤੱਕ ਹਾਂ ਉਨ੍ਹਾਂ ਉਨ੍ਹਾਂ ਵਾਸਤੇ ਹਾਂ ਹੋ ਸਕਦਾ ਉੱਥੇ ਪਤਾ ਪੁਤਾ ਕਰਿਆ ਜਾਵੇ ਵੀ ਫੀਸਾਂ ਵਗੈਰਾ ਸਾਰੀ ਗੱਲਬਾਤ ਹੈ ਨਾ ਹਾਂ ਇੱਕ ਮੇਰੇ ਦੋਸਤ ਹੈਗੇ ਇੱਥੇ ਉਨ੍ਹਾਂ ਤੋਂ ਪਤਾ ਪੁਤਾ ਕਰਾ ਲਈਏ ਅਤੇ ਫਿਰ ਹੁਣ ਕਈ ਗੱਲਾਂ ਯਾਰ ਪੜ੍ਹਾਈ ਵੀ ਹੋਵੇ ਅੱਜ ਕੱਲ੍ਹ ਜਿਹੜਾ ਮਾੜਾ ਬੱਚੇ ਵਿਗੜ ਜਾਂਦੇ ਆ ਉਹ ਜਿਹੀਆਂ ਗੱਲਾਂ ਤੋਂ ਬਚਤ ਵੀ ਰਹੇ ਫਿਰ ਅੱਜ ਕੱਲ੍ਹ ਇਹ ਪ੍ਰਾਈਵੇਟ ਸਕੂਲਾਂ 'ਚ ਲੁੱਟ ਵਧੀ ਹੋਈ ਹੈ ਪੈਸੇ ਪੁਸੇ ਵੀ ਜ਼ਿਆਦਾ ਵਸੂ ਬਾ ਬਾਹਲੇ ਵਸੂਲਦੇ ਆ ਉਸ ਤੋਂ ਵੀ ਆਪਾਂ ਬਚਾਅ ਰੱਖ ਕੇ

ਹਾਂ ਅਤੇ ਉਹ ਸਾਰੇ ਬੱਚੇ ਨਾ ਅ ਅ ਨਾਲੇ ਇੱਕ ਜਗ੍ਹਾ ਜਾਣ ਆਉਣ ਜਾਣ ਆਉਣ ਦਾ ਸੁੱਖ ਹੋਜੂ ਐਂ ਕੋਈ ਨਾ ਕੋਈ ਤਰੀਕਾਕਾਰ ਜਿਹਾ ਬਣ ਜਾਵੇਗਾ ਚਲੋ ਆਪਾਂ ਕੋਈ ਨਾ ਕੋਈ ਆਪਾਂ ਰਾਏ ਕਰਕੇ ਸਾਰੇ ਠੀਕ ਹੈ ਨਾ ਹਾਂ ਚੰਗਾ ਜੀ ਫਿਰ